ਮੇਰਾ ਨਾਮ ਅੰਗਰੇਜ਼ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹਾਂ ਮੈਂ ਸਿੱਖ ਧਰਮ ਮੰਨਦਾ ਹਾਂ ਸਾਡੇ ਸਿੱਖ ਧਰਮ ਵਿੱਚ ਦਸ ਗੁਰੂ ਹਨ ਸਿੱਖ ਗੁਰੂਆਂ ਦੇ ਵਿਚਾਰ ਅਤੇ ਯੋਗਦਾਨ ਵਿੱਚ ਸੱਭਿਆਚਾਰ ਸਮਾਜ ਵਿਕਾਸ ਵਿੱਚ ਹਰੇਕ ਗੁਰੂ ਨੇ ਕਿਵੇਂ ਵਿਲੱਖਣ ਯੋਗਦਾਨ ਪਾਇਆ ਸਾਡੇ ਧਰਮ ਵਿੱਚ ਦਸ ਗੁਰੂ ਹਨ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਨੂੰ ਜੀਵਨ ਕਾਲ ਵਿੱਚ ਚਾਰ ਉਦਾਸੀਆਂ ਕੀਤੀਆਂ ਚਾਰੇ ਦਿਸ਼ਾਵਾਂ ਵਿੱਚ ਸਭ ਦੁਨੀਆ ਚੰਗੇ ਕਰਮ ਕਰਨ ਦੀ ਸਿੱਖਿਆ ਦਿੱਤੀ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੂਜੇ ਗੁਰੂਆਂ ਨੂੰ ਆਪਣੇ ਜੀਵਨ ਕਾਲ ਵਿੱਚ ਸਿੱਖਿਆ ਨੂੰ ਸਰੀਰ ਨੂੰ ਤੰਦਰੁਸਤ ਰੱਖਣ ਲਈ ਖਡੂਰ ਸਾਹਿਬ ਭਲਵਾਨੀ ਦੇ ਅਖਾੜੇ ਦੀ ਸਥਾਪਨਾ ਕੀਤੀ ਗੁਰੂ ਜੀ ਨੇ ਸਰੀਰ ਦੀ ਸੁਤੰਦਰੁਸਤੀ ਲਈ ਜਾਨੀ ਕੁਰਬਾਨੀਆਂ ਕੁਰਬਾਨੀਆਂ ਗੁਰੂ ਜੀ ਨੇ ਗੁਰਮੁ ਗੁਰਸਿੱਖੀ ਲਿਪੀ ਦੀ ਗੁਰਮੁਖੀ ਲਿਪੀ ਦੀ ਸਥਾਪਨਾ ਕੀਤੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸਿੱਖਾਂ ਦਾ ਪ੍ਰਚਾਰ ਕਰਨ ਲਈ ਬਹੁਤ ਕੁਰਬਾਨੀਆ ਦਿੱਤੀਆਂ ਅਤੇ ਸਾਰੇ ਗੁਰੂ ਜੀ ਸਿੱਖਿਆ ਦਿੰਦੇ ਹਨ ਕੀ ਨੀਵੀ ਜਾਤ ਅਤੇ ਉੱਚੀ ਜਾਤ ਲਈ ਫ਼ਰਕ ਨਹੀਂ ਕਰਨਾ ਚਾਹੀਦਾ ਅਤੇ ਗੁਰੂ ਜੀ ਇਹ ਵੀ ਇਹ ਵੀ ਦੱਸਦੇ ਹਨ ਇਹ ਵੀ ਸਿੱਖਿਆ ਦਿੰਦੇ ਹਨ ਕਿ ਸਾਨੂੰ ਕਿਸੇ ਵੀ ਧਰਮ ਨੂੰ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ ਜਾਂ ਕੋਈ ਵੀ ਧਰਮ ਹੋਵੇ ਆਪਾਂ ਨੂੰ ਨਾ ਮਾੜਾ ਨਾ ਚੰਗਾ ਕਿਸੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਸਭ ਨੂੰ ਇੱਕ ਬਰਾਬਰ ਹੀ ਸਮਝਣਾ ਚਾਹੀਦਾ ਸਾਡੇ ਗੁਰੂ ਜੀ ਸਾਨੂੰ ਇਹ ਦੱਸਦੇ ਹਨ